ਹਾਂਜੀ ਨਮਸਤੇ ਦੀਦੀ ਹੋਰ ਹਾਂ ਵਧੀਆ ਤੁਸੀਂ ਸਣਾਓ ਠੀਕ ਠਾਕ ਕਿਵੇਂ ਅੱਜ ਮੀਂਹ ਮੂਹ ਹਾਂ ਹੋਰ ਬੱਚੇ ਠੀਕ ਹੈ ਸਾਰੇ ਠੀਕ ਹੈ ਵਧੀਆ ਗਰਮੀ ਬਹੁਤ ਹੈ ਹੈ ਨਾ ਅੱਜ ਕਿਵੇਂ ਯਾਦ ਕਰ ਲਿਆ ਹਾਂ ਹਾਂ ਮੈਂ ਵੀ ਇਹੀ ਸੋਚਿਆ ਸੀ ਮੈਂ ਵੀ ਸੋਚਿਆ ਸੀ ਮੈਂ ਖਾਂ ਮੈਂ ਲਾਉਂਦੀ ਐ ਦੀਦੀ ਨੂੰ ਫੋਨ ਬਸ ਘਰ ਦੇ ਕੰਮਾਂ ਜਿਆਂ 'ਚ ਕਦੇ ਇੱਧਰ ਕਦੇ ਇੱਧਰ ਆਂਏ ਜਿਹੇ ਚੱਲੀ ਗਿਆ ਅਤੇ ਸੋਚਦੇ ਮੈਂ ਵੀ ਹਾਂ ਹਾਂ ਨਾ ਦੇਖਦੇ ਹਾਂ ਪਰ ਕਹੀ ਜਾਂਦੇ ਸੀ ਇਹਦੇ ਡੈਡੀ ਵੀ ਕਹਿੰਦੇ ਆਪਾਂ ਦੇਖੋ ਕਿੱਥੇ ਪੜ੍ਹਨ ਲਾਉਣੇ ਹੈ ਕਿਉਂਕਿ ਤੁਹਾਡੇ ਵਾਲੇ ਬੱਚੇ ਦਾ ਵੀ ਸੀਗਾ ਵੀ ਨਾਲ ਚੱਲ ਇਕੱਠੇ ਪੜ੍ਹਦੇ ਹੈ ਸ਼ੁਰੂ ਤੋਂ ਹਾਂਜੀ ਦੇਖਦੇ ਸੀ ਪਹਿਲਾਂ ਤਾਂ ਬੁਢਲਾਢੇ ਕਹਿੰਦੇ ਸੀ ਮਨੂ ਵਾਟਿਕਾ ਡੀ ਏ ਵੀ ਹੈ ਫੇਰ ਕਹਿੰਦੇ ਵੀ ਇੱਧਰ ਆਪਣੇ ਮਾਨਸਾ ਵੀ ਵਧੀਆ ਡੀ ਏ ਵੀ ਹੈ ਸਿੰਗਲ ਸਟਾਰ ਐਂ ਤਾਂ ਹੈ ਨਾ ਇੱਧਰ ਹੀ ਲਾ ਦਿੰਦੇ ਨਾਲੇ ਮਾਨਸਾ ਜ਼ਿਲ੍ਹੇ ਦਾ ਫਿਰ ਵੀ ਫਰਕ ਹੁੰਦਾ ਬਾਕੀ ਸਕੂਲ ਬਹੁਤ ਵਧੀਆ ਨੇ

ਹਾਂ ਹਾਂ ਹਾਂ ਨਹੀਂ ਹਾਂ ਨਾਲੇ ਵਧੀਆ ਇਨ੍ਹਾਂ ਦੀ ਹੁਣ ਆਪਾਂ ਬੇਸ ਜਿਹਾ ਵਧੀਆ ਬਣਿਆ ਹੋਇਆ ਆਪਾਂ ਵਧੀਆ ਸਕੂਲ 'ਚ ਪਾ ਦੇਈਏ ਤਾਂ ਅੱਗੇ ਨਹੀਂ ਇਨ੍ਹਾਂ ਨੂੰ ਪ੍ਰੋਬਲਮ ਆਊਗੀ ਫਿਰ ਬੱਚੇ ਦਾ ਹਾਂ ਜਿਹੋ ਜਿਹੇ ਬੱਚਿਆਂ 'ਚ ਬੈਠਣੀ ਉੱਠਣੀ ਬੱਚਿਆਂ ਦੀ ਉਹ ਅੱਛੇ ਸਕੂਲ 'ਚ ਪਾਵਾਂਗੇ ਫੇਰ ਹੀ ਫਾਇਦਾ ਬੱਚਿਆਂ ਦੀ ਪੜ੍ਹਾਈ ਦਾ ਹੈ ਨਾ ਅੱਛਾ ਜੇ ਆਰ ਮਲੀਨੀਅਮ ਵੀ ਹੈਗਾ ਊਂ ਅਸੀਂ ਇੱਕ ਦੋ ਪ ਸਕੂਲਾਂ ਦਾ ਪਤਾ ਕਰਿਆ ਸੀ ਇਹਨਾਂ ਨੇ ਉਹ ਕਹਿੰਦੇ ਸੀ ਵੀ ਜਾਂ ਸਿੰਗਲ ਸਟਾਰ ਉੱਥੇ ਤਾਂ ਮੇਰੀ ਨਾ ਜੇਠਾਣੀ ਵੀ ਹੈ ਉਹ ਪੜ੍ਹਾਉਂਦੀ ਹੈ ਕੰਪਿਊਟਰ ਟੀਚਰ ਹੈ ਉਹ ਵੀ ਕਹਿੰਦੇ ਸੀ ਕਹਿੰਦੇ ਵੀ ਆ ਕੇ ਵੀ ਦੇਖਜੋ ਉੱਥੇ ਪੇਪਰ ਦੇਵਾ ਦਾਂਗੇ ਪਹਿਲਾਂ ਆਪਾਂ ਉਹ ਨਾ ਐਂਟਰੈਸ ਟੈਸਟ ਜਿਹਾ ਲੈਂਦੇ ਹੈ ਨਾਲੇ ਆਪਾਂ ਨੂੰ ਪਤਾ ਲੱਗ ਜੂ ਵੀ ਬੱਚੇ ਕਿਵੇਂ ਜੇ ਹੈ ਅਤੇ ਫਿਰ ਉਹ ਅਡਮੀਸ਼ਨ ਲੈ ਲੈਂਦੇ ਨੇ ਅਤੇ ਖਰਚਾ ਖੁਰਚਾ ਵੀ ਠੀਕ ਹੈ ਕੋਈ ਐਨਾ ਨਹੀਂ ਨਾਲੇ ਨਾ ਬਹੁਤ ਵਧੀਆ ਉੱਥੇ ਕੇਅਰਟੇਕਰ ਜਿਹੜੀਆਂ ਹੈਗੀਆਂ ਨੇ ਆਂਟੀਆਂ ਵਗੈਰਾ ਊਂ ਵੀ ਵਧੀਆ ਨੇ ਆਏ ਨਹੀਂ ਵੀ ਨਾ ਜਿਵੇਂ ਕੋਈ ਲੰਚ ਬ੍ਰੇਕ ਵਗੈਰਾ 'ਚ ਪ੍ਰੋਬਲਮ ਨਹੀਂ ਆਉਂਦੀ ਬੱਚਿਆਂ ਨੂੰ ਹਾਂ ਹਾਂ ਹਾਂ ਵੈਨਸ ਦਾ ਵੀ ਫੈਸਲਿਟੀ ਬੋ ਹਾਂ ਫੀਸ ਵੀ ਹਾਂ ਇਹ ਕਹਿੰਦੇ ਸੀ ਕਹਿੰਦੇ ਮੈਂ ਇੱਕ ਦੋ ਸਕੂਲਾਂ ਦਾ ਪਤਾ ਕਰਿਆ ਇੱਧਰ ਹੈਗਾ ਮੈਨੂੰ ਲੱਗਦਾ ਪੰਜਾਹ ਸੱਠ ਕੁ ਹਜ਼ਾਰ ਰੁਪਈਆ ਖਰਚਾ ਆ ਜਾਂਦਾ ਊਂ ਠੀਕ ਹੈ ਵਧੀਆ ਪਰ ਵੀ ਐਂ ਫਿਰ ਉਹ ਸਾਰਾ ਕੁਛ ਹੀ ਵਿੱਚ ਹੈ ਸਟੇਸ਼ਨਰੀ ਵਗੈਰਾ ਵੀ ਦੇਣਗੇ ਬਾਕੀ ਟੀਚਰ ਵਧੀਆ ਬਾਹਰੋਂ ਨੇ ਇਹਨਾਂ ਦੇ ਪੜ੍ਹਾਉਣ ਵਾਲੇ ਐਂ ਨਹੀਂ ਹੈਗਾ ਵੀ ਇਹ ਆਮ ਜਿਹੇ ਟੀਚਰ ਰੱਖ ਲੈਣਗੇ ਵਧੀਆ ਨੈੱਟ ਕੁਆਲੀਫਾਈਡ ਵਧੀਆ ਹਾਂ ਸਕੂਲ ਵਧੀਆ ਮਿਲ ਜਾਣਾ ਉਹ ਤਾਂ ਹੈ ਫਿਰ ਆਪਾਂ ਨੂੰ ਟਿਊਸ਼ਨ ਦੀ ਲੋੜ ਨਹੀਂ ਪੈਣੀ ਉਹੀ ਜਿਹੜੇ ਦੋ ਪੈਸੇ ਇੱਧਰ ਲੱਗਣਗੇ ਉਹੀ ਫੇਰ ਆਪਣੇ ਟਿਊਸ਼ਨ ਵਾਲੇ ਬਚ ਜਾਣਗੇ ਹੈ ਨਾ ਆਂਏ ਹੋ ਜੂਗਾ ਹਾਂ ਹਾਂ ਹੋਰ ਹਾਂ ਹਾਂ ਨਾ ਇਹ ਕਹਿੰਦੇ ਸੀ ਅੱਜ ਬਾ ਮੀਂਹ ਜੇ ਬਾਰਿਸ਼ ਜੇ ਕਰਕੇ ਰੁਕ ਗਏ ਅਤੇ ਕਹਿੰਦੇ ਕਹਿੰਦੇ ਸ਼ਾਇਦ ਮੈਂ ਕੱਲ ਨੂੰ ਦੁਬਾਰਾ ਜਾ ਕੇ ਆਊਂਗਾ ਇਨ੍ਹਾਂ ਦੋਨਾਂ ਤਿੰਨਾਂ ਸਕੂਲਾਂ ਦਾ ਪਤਾ ਕਰਕੇ ਫਿਰ ਆਪਾਂ ਕਿਸੇ ਇੱਕ ਸਕੂਲ 'ਚ ਵਧੀਆ ਅਡਮੀਸ਼ਨ ਕਰਵਾ ਦਾਂਗੇ ਬੱਚੇ ਦੀ ਹੈ ਨਾ ਜਿਹੜੇ ਸਕੂਲ 'ਚ ਵਧੀਆ ਸਹੂਲਤ ਹੋਈ ਹਾਂ ਹਾਂ ਹਾਂ ਸਾਰੇ ਵਧੀਆ ਠੀਕ ਹੈ ਠੀਕ ਹੈ ਜੀ ਓਕੇ ਬਾਏ ਬਾਏ